ਹੈਲੋ ਹਾਂਜੀ ਅਸੀਂ ਘੁੰਮਣ ਜਾਣਾ ਜੀ ਅਸੀਂ ਕੈਬ ਬੁੱਕ ਕਰਨੀ ਹੈ ਅਤੇ ਉਹ ਮੈਨੂੰ ਸਾਨੂੰ ਇੱਕ ਕੋਡ ਮਿਲਿਆ ਹੋਇਆ ਜੋ ਕੋਡ ਮਿਲਿਆ ਏਜੰਸੀ ਦਾ ਟਰਾਂਸਪੋਰਟ ਏਜੰਸੀ ਦੇ ਕੋਡ ਮਿਲਿਆ ਹੋਇਆ ਉਹ ਕੋਡ ਵਿ ਏਜ ਏਜੰਸੀ ਤੋਂ ਸਾਨੂੰ ਛੂਟ ਹੈ ਉਹ ਕੋਡ ਕੋਡ ਇਸਤੇਮਾਲ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਏਜੰਸੀ ਤੋਂ ਕੋਡ ਮਿਲੇ ਕੋਡ ਮਿਲੇ ਦੀ ਦੋਸਤ ਕੋਡ ਮਿਲਿਆ ਹੈ ਜੋ ਉਸ ਉਹ ਕੋਡ ਦੇ ਰਿਗਾਰਡਿੰਗ ਅਸੀਂ ਦੋਸਤਾਂ ਨਾਲ ਘੁੰਮਣ ਜਾਣਾ ਤਾਂ ਕੈਬ ਬੁੱਕ ਕਰਨੀ ਹੈ ਵੀ ਇਸ ਕੈਬ ਕੈਬ ਦਾ ਜੋ ਵੀ ਛੂਟ ਮਿਲੀ ਹੋਈ ਆ ਉਹ ਛੂਟ ਸੰਬੰਧੀ ਸਾਨੂੰ ਸਹੂਲਤਾਂ ਮਿਲਣ